ਹਾਂਜੀ ਮੈਂ ਸਿਲਾਈ ਹੀ ਕਰ ਰਹੀ ਹਾਂ ਪਰ ਸਿਲਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਜਿਹੜੇ ਅੱਜ ਕੱਲ੍ਹ ਹੁਣ ਕੱਪੜੇ ਚੱਲੇ ਨੇਗੇ ਸਿਲਕੀ ਸੂਟ ਨੇਗੇ ਅਤੇ ਜ਼ਿਆਦਾ ਪਿਓਰ ਕਾਟਨ ਦੇ ਸੂਟ ਨੇ ਸਾਰਿਆਂ ਨੂੰ ਪਹਿਲਾਂ ਪ੍ਰੈਸ ਕੀਤਾ ਜਾਂਦਾ ਆ ਫਿਰ ਉਹਨੂੰ ਅੱਗੋਂ ਵੀ ਕਟਿੰਗ ਕਰਨ 'ਚ ਪ੍ਰੋਬਲਮ ਆਉਂਦੀ ਆ ਕਿਉਂਕਿ ਜਿੱਥੇ ਮੋਤੀ ਲੱਗੇ ਹੁੰਦੇ ਨੇ ਮੋਤੀ ਉਤਾਰਨੇ ਲੱਗਦੇ ਨੇ ਜਦ ਅਸੀਂ ਸੂਟ ਸ ਸਿਲਾਈ ਕਰਦੇ ਹਾਂ ਤਾਂ ਫਿਰ ਉਦੋਂ ਵੀ ਉਦੋਂ ਸੂਈਆਂ ਕਾਫੀ ਟੁੱਟਦੀਆਂ ਨੇਗੀਆਂ ਮੋਤੀ ਉਤਾਰ ਤਾਰ ਕੇ ਮਸ਼ੀਨ ਚਲਾਉਣੀ ਪੈਂਦੀ ਹੈ ਅਤੇ ਤਾਂ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਆ ਪਰ ਅਗਲਾ ਕਹਿ ਦਿੰਦਾ ਕਿ ਸਿਲਾਈ ਬਹੁਤ ਜ਼ਿਆਦਾ ਲੈਂਦੇ ਹਨ ਪਰ ਸਿਲਾਈ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਸਾਨੂੰ ਬਹੁਤ ਔਖਾ ਹੁੰਦਾ ਹੈ ਕਿਉਂਕਿ ਮਿਹਨਤ ਤਾਂ ਬਹੁਤ ਜ਼ਿਆਦਾ ਆ ਪਰ ਉਹ ਉਨੀ ਸਾਨੂੰ ਸਿਲਾਈ ਨਹੀਂ ਨਹੀਂ ਮਿਲਦੀ ਹੈਗੀ ਜਿੰਨੀ ਸਾਡੀ ਮਿਹਨਤ ਹੁੰਦੀ ਹੈ ਪਰ ਮੈਂ ਕਹਿੰਦੀ ਵੀ ਕੱਪੜੇ ਨੂੰ ਐਨ ਸਮਾਰ ਸਮਾਰ ਕੇ ਦੇਖ ਕੇ ਐਨ ਠੀਕ ਤਰੀਕੇ ਨਾਲ ਸਿਲਾਈ ਕਰਨਾ ਪੈਂਦਾ ਹੈ ਅਤੇ ਬਹੁਤ ਪਿਆਰ ਨਾਲ ਕਰਦੇ ਹਨ